ਟੈਕਨੋਲਜੀ ਦੇ ਵਿਕਾਸ ਦੇ ਨਾਲ ਆਈ ਟੀ ਸੈਕਟਰ ਦੀਆਂ ਨੌਕਰੀਆਂ ਬਹੁਤ ਖੁੱਲੀਆਂ ਨੇ ਜਿਵੇਂ ਕਿ ਏ ਆਈ ਦਾ ਕੰਮ ਬਹੁਤ ਵਧਿਆ ਹੈ ਏ ਆਈ ਨਾਲ ਸਬੰਧਿਤ ਬਹੁਤ ਡਿਗਰੀਆਂ ਸ਼ੁਰੂ ਹੋ ਗਈਆਂ ਨੇ ਅਤੇ ਬੀ ਐੱਸ ਈ ਆਈ ਟੀ ਬੀ ਐੱਸ ਈ ਏ ਆਈ ਵਰਗੀਆਂ ਡਿਗਰੀਆਂ ਨੇ ਜਿਹੜੀਆਂ ਕਿ ਅੱਜ ਕੱਲ੍ਹ ਵਿਦਿਆਰਥੀ ਕਰਨਾ ਪਸੰਦ ਕਰਦੇ ਨੇ ਇਹ ਤੋਂ ਇਲਾਵਾ ਬੀ ਟੈੱਕ ਹੈ ਜਿਹੜੀ ਕਿ ਪਹਿਲਾਂ ਤੋਂ ਹੀ ਚੱਲੀ ਆ ਰਹੀ ਹੈ ਬੀ ਟੈੱਕ ਐੱਮ ਟੈੱਕ ਹੋਗੀ ਅਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਇੰਟ੍ਰਸਟ ਹੁੰਦਾ ਅਤੇ ਫਿਰ ਉਹ ਟੈਕਨੋਲਜੀ ਨਾਲ ਰਿਲੇਟਡ ਡੋਕਟਡ ਵੀ ਕਰਦੇ ਨੇ ਟੈਕਨੋਲਜੀ ਨਾਲ ਰਿਲੇਟਡ ਡਿਗਰੀਆਂ ਕਰਨ ਦਾ ਮਹੱਤਵ ਇਹ ਹੀ ਹੈ ਕਿ ਹੁਣ ਸਮਾਜ ਦਿਨੋਂ ਦਿਨ ਤਰੱਕੀ ਕਰ ਰਿਹਾ ਹੈ ਟੈਕਨੋਲਜੀ ਨੂੰ ਲੈ ਕੇ ਅਤੇ ਹੁਣ ਜ਼ਿਆਦਾ ਮੰਗ ਟੈਕਨੀਕਲ ਕੰਮਾਂ ਦੀ ਹੈ ਇਸ ਲਈ ਵਿਦਿਆਰਥੀ ਇਸ ਚੀਜ਼ ਵਿੱਚ ਜ਼ਿਆਦਾ ਉਤਸਾਹ ਦਿਖਾ ਰਹੇ ਨੇ